ਹੈਲੋ ਹੈਲੋ ਠੀਕ ਹੈ ਠੀਕ ਹੈ ਰਾਜਵੀਰ ਤੂੰ ਦੱਸ ਕੁਛ ਨਹੀਂ ਬਸ ਬੈਠੇ ਘਰ ਕਿਆ ਕਰਨਾ ਹੈਲੋ ਫਸਲਾਂ ਠੀਕ ਹੈ ਯਾਰ ਮਾੜਾ ਹੀ ਹਾਲ ਆ ਵੈਸੇ ਠ ਗਲੋਬਲ ਵਾਰਮਿੰਗ ਕਰਕੇ ਯਾਰ ਠੰਡ ਠੁੰਡ ਘੱਟ ਹੋ ਗਈ ਹੈ ਧੁੰਦਾਂ ਜੇ ਘੱਟ ਪਈਆਂ ਬਹੁਤ ਇਸ ਕਰਕੇ ਘੱਟ ਪੱਕ ਰਹੀ ਕਣਕ ਹਾਂ ਝਾੜ ਵੀ ਘੱਟੇ ਨਿਕਲਣਾ ਐਤਕੀ ਹਾਂ ਔਰ ਰੇਟ ਬਹੁਤ ਘੱਟ ਲੱਗਿਆ ਉਹਦਾ ਵੀ ਝੋਨੇ ਦਾ ਵੀ ਹੂੰ ਹਾਂ ਉਹਦਾ ਵੀ ਖਰਚਾ ਅਲੱਗ ਪੈ ਗਿਆ ਹਾਂ ਫ਼ਾਇਦਾ ਤਾ ਕੋਈ ਨਹੀਂ ਹੋਇਆ ਐਤਕੀ ਘਾਟੇ 'ਚ ਰਹੇ ਹਾਂ ਕਿਆ ਕਹਿੰਦਾ ਹੋਰ ਕਿਆ ਜ਼ੀਰੀ ਲਾਉਗੇ ਝੋਨਾ ਉਹਦੀ ਪਨੀਰੀ ਪਨੂਰੀ ਕਰਦੇ ਹਾਂ ਪਨੀਰੀ ਪਨੂਰੀ ਤਿਆਰ ਕਰਦੇ ਹਾਂ ਕੁਛ ਨਹੀਂ ਪਤਾ ਕਿਤੇ ਮੀਂਹ ਮੂੰਹ ਜ਼ਿਆਦਾ ਪੈ ਜਾਵੇ ਫਿਰ ਝੜ ਝੁੜ ਵੀ ਜਾਂਦਾ ਖੇਤ 'ਚ ਹਾਂ ਹਾਂ ਕਈ ਵਾਰ ਜ਼ਿਆਦਾ ਹੀ ਗਰਮੀ ਹੋ ਜਾਂਦੀ ਨਹੀਂ ਤਾਂ ਹੁੰਦੀ ਓ ਨਹੀਂ ਗਰਮੀ ਮੀਂਹ ਜ਼ਿਆਦਾ ਪੈਣ ਲੱਗ ਜਾਂਦਾ ਕਈ ਵਾਰ ਪੈਂਦਾ ਹੀ ਨਹੀਂ ਹੈ ਹਾਂ ਅਤੇ ਹੜ ਆ ਜਾਂਦੇ ਜਾਏ ਜਾਂ ਜਾ ਫਸਲ ਪੱਕਣੇ ਵਾਲੀ ਹੁੰਦੀ ਫਿਰ ਗੜੇ ਪੈ ਜਾਂਦੇ ਉੱਪਰ ਹੁਣ ਵੀ ਕਣਕਾਂ ਦਾ ਬਹੁਤ ਨੁਕਸਾਨ ਹੋਇਆ ਗੜੇ ਪੈਣੇ ਕਰਕੇ ਹਾਂ ਬਹੁਤ ਨੁਕਸਾਨ ਹੋ ਗਿਆ ਗੜਿਆਂ ਨਾਲ ਹਾਂ ਫਸਲ ਗਿਰ ਜਾਂਦੀ ਸਾਰੀ ਹਵਾ ਚੱਲਦੀ ਹਨੇਰੀ ਚੱਲਦੀ ਉਹਦੇ ਨਾਲ ਫਸਲ ਗਿਰ ਗਈ ਉਹਦੇ ਕਰਕੇ ਮਸ਼ੀਨ ਦਾ ਵੀ ਫਿਰ ਔਖਾ ਹੈ ਵੱਢਣੀ ਹਾਂ ਹੋਰ ਤੁਹਾਡੀ ਠੀਕ ਹੈ ਫਸਲ ਹੋਰ ਹੋਰ ਨਾ ਹਾਲੇ ਤਾਂ ਘਰ ਹੀ ਬੈਠਾ ਤਾ ਮੈਂ ਦੇਖਦੇ ਕੋਈ ਕੰਮ ਕੁੰਮ ਜਾਂਦੇ ਕਿਤੇ ਠੀਕ ਆ